ਮੇਰੀ ਜਿਹੜੀ ਮਨਪਸੰਦ ਗੇਮ ਹੈਗੀ ਹੈ ਉਹ ਹੈਗੀ ਕ੍ਰਿਕਟ ਅਤੇ ਅਸੀਂ ਸ਼ੁਰੂ ਤੋਂ ਸਕੂਲ ਟਾਈਮ ਤੋਂ ਮਤਲਬ ਜਦੋਂ ਛੋਟੇ ਹੁੰਦੇ ਤੋਂ ਦੇਖਦੇ ਵੀ ਕ੍ਰਿਕੇਟ ਰਹੇ ਹਾਂ ਅਤੇ ਖੇਡ ਵੀ ਕ੍ਰਿਕੇਟ ਰਹੇ ਹਾਂ ਅਤੇ ਕ੍ਰਿਕਟ ਵਿੱਚ ਦਸ ਪਲੇਅਰ ਹੁੰਦੇ ਨੇ ਇੱਕ ਟੀਮ ਦੇ ਪਰ ਉਹ ਵੱਡੇ ਲੈਵਲ 'ਤੇ ਅਗਰ ਛੋਟੇ ਲੈਵਲ ਦੀ ਗੱਲ ਕਰੋ ਤਾਂ ਪੰ ਗਲੀ ਮੁਹੱਲੇ ਦੇ ਬੱਚੇ ਪੰਜ ਪੰਜ ਬੱਚੇ ਵੀ ਮਿਲ ਕੇ ਟੀਮ ਬਣਾ ਕੇ ਖੇਡ ਲੈਂਦੇ ਨੇ ਅਤੇ ਉਸ ਗੇਮ 'ਚ ਇਹ ਹੁੰਦਾ ਹੈ ਕਿ ਦੋ ਟੀਮਾਂ ਮਿਲ ਕੇ ਪਹਿਲਾਂ ਜਿੱਦਾਂ ਦੋ ਟੀਮਾਂ ਬਣਦੀਆਂ ਅਤੇ ਫਿਰ ਆਪਸ 'ਚ ਸਭ ਤੋਂ ਪਹਿਲਾ ਟੌਸ ਕੀਤੀ ਜਾਂਦੀ ਹੈ ਅਤੇ ਜੋ ਟੌਸ ਜਿੱਤਦਾ ਉਹਨੂੰ ਪਹਿਲਾਂ ਬੈਟਿੰਗ ਦਿੱਤੀ ਜਾਂਦੀ ਹੈ ਅਤੇ ਜਿਹੜਾ ਟੌਸ ਹਾਰਦਾ ਉਹਨੂੰ ਪਹਿਲਾਂ ਬੌਲਿੰਗ ਮਿਲਦੀ ਹੈ ਅਤੇ ਉਸ ਦੇ ਹਿਸਾਬ ਨਾਲ ਫਿਰ ਬੈਟਿੰਗ ਸ਼ੁਰੂ ਕੀਤੀ ਜਾਂਦੀ ਹੈ ਵੱਡੇ ਮੈਚ ਜਿਹੜੇ ਹੁੰਦੇ ਨੇ ਜਿੱਦਾਂ ਇੰਟਰਨੈਸ਼ਨਲ ਨੈਸ਼ਨਲ ਉਹ ਅੱਜ ਕੱਲ੍ਹ ਟਵੈਂਟੀ ਟਵੈਂਟੀ ਜਾਂ ਫਿਫਟੀ ਓਵਰ ਦੇ ਹੁੰਦੇ ਨੇ ਅਤੇ ਜਾਂ ਟੈਸਟ ਮੈਚ ਜਿਹੜੇ ਪੰਜ ਪੰਜ ਦਿਨ ਚੱਲਦੇ ਨੇ ਪਰ ਜਿਹੜੇ ਗਲੀ ਮੁਹੱਲੇ ਦੇ ਬੱਚੇ ਖੇਡਦੇ ਨੇ ਉਹ ਪੰਜ ਪੰਜ ਓਵਰ ਦਾ ਮਤਲਬ ਕਿ ਮੈਚ ਲਾਉਂਦੇ ਨੇ ਅਤੇ ਉਹਦੇ ਵਿੱਚ ਗੇਮ ਦੇ ਵਿੱਚ ਫਿਰ ਸ਼ੁਰੂ ਹੁੰਦਾ ਹੈ ਗੇਮ ਉਹ 'ਚ ਹੁੰਦੇ ਨੇ ਪਲੇਅਰ ਹੁੰਦੇ ਨੇ ਜੇ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਜੇ ਨੈਸ਼ਨਲ ਲੈਵਲ 'ਚ ਦਸ ਦਸ ਦੋਨਾਂ ਸਾਈਡ 'ਤੇ ਗਿਆਰਾਂ ਗਿਆਰਾਂ ਪਲੇਅਰ ਹੁੰਦੇ ਨੇ ਅਤੇ ਦੋ ਅੰਪਾਇਰ ਹੁੰਦੇ ਨੇ ਇੱਕ ਹੁੰਦਾ ਮੇਨ ਅੰਪਾਇਰ ਇੱਕ ਹੁੰਦਾ ਲੈੱਗ ਸਾਈਡ 'ਤੇ ਅੰਪਾਇਰ ਅਤੇ ਫਿਰ ਹੁੰਦੀ ਹੈ ਬੈਟਿੰਗ ਬੈਟਿੰਗ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਸਕੋਰ ਮਾਰਦਾ ਅਤੇ ਉਹ ਟੀਮ ਜੇਤੂ ਮੰਨੀ ਜਾਂਦੀ ਹੈ ਅਤੇ ਇਹਦੇ ਵਿੱਚ ਕੁਛ ਨਵੇਂ ਰੂਲ ਜਿੱਦਾਂ ਕਿ ਅੱਜ ਕੱਲ੍ਹ ਆ ਗਏ ਨੇ ਅਤੇ ਉਹ 'ਚ ਡੀ ਆਰ ਐੱਫ ਅਤੇ ਕੁਛ ਹੋਰ ਰੂਲ ਲਾਗੂ ਜਿੱਦਾਂ ਜਿੱਦਾਂ ਕਿ ਕੋਈ ਬੰਦੇ ਨੇ ਰਿਵਿਊ ਲੈਣਾ ਹੈ ਰਿਵਿਊ ਸਿਸਟਮ ਅੱਜ ਕੱਲ੍ਹ ਆ ਗਿਆ ਹੈ ਮੰਨ ਲਓ ਕਿਸੇ ਅੰਪਾਇਰ ਨੇ ਬੱਚੇ ਨੂੰ ਉਹ ਜਾਂ ਪਲੇਅਰ ਨੂੰ ਆਊਟ ਦੇ ਤਾ ਹੈ ਪਰ ਉਹ ਰਿਵਿਊ ਲੈਂਦਾ ਹੈ ਕਿ ਮੇਰੀ ਜਿਹੜੀ ਬੋਲ ਆ ਉਹ ਮੇਰੇ ਬੈਟ 'ਤੇ ਲੱਗੀ ਨਹੀਂ ਹੈ ਅਤੇ ਅੰਪਾਇਰ ਨੇ ਫਿਰ ਵੀ ਉਹਨੂੰ ਗਲਤੀ ਨਾਲ ਆਊਟ ਦੇ ਤਾ ਆ ਉਹ 'ਚ ਕੀ ਹੁੰਦਾ ਫਿਰ ਅੰਪਾਇਰ ਜਾਂਦਾ ਥਰਡ ਅੰਪਾਇਰ ਦੇ ਕੋਲ ਥਰਡ ਅੰਪਾਇਰ ਉੱਥੇ ਪ੍ਰੋਪਰ ਮੋਨੀ ਮੋਨੀਟਰ 'ਚ ਚੈੱਕ ਕਰਦਾ ਵੀ ਅਲਟਰਾ ਐਜ ਤਾਂ ਨਹੀਂ ਲੱਗਾ ਜੇ ਨਹੀਂ ਲੱਗਾ ਤਾਂ ਬੋਲ ਫਿਰ ਕਿੱਥੇ ਲੱਗੀ ਹੈ ਕੋਈ ਨੋ ਬੋਲ ਤਾਂ ਨਹੀਂ ਸੀਗੀ ਕੋਈ ਪਲੇਅਰ ਦਾ ਪੈਰ ਅੱਗੇ ਤਾਂ ਨਹੀਂ ਸੀ ਬੋਲਰ ਦਾ ਉਹ ਚੈੱਕ ਕਰ ਕੇ ਅਤੇ ਫਿਰ ਉਸ ਦੇ ਹਿਸਾਬ ਨਾਲ ਆਪਣਾ ਡਸੀਜ਼ਨ ਲਿੱਤਾ ਜਾਂਦਾ ਹੈ